ਪ੍ਰਿੰਟ ਮੀਡੀਆ ਜਿਵੇਂ ਕਿ ਅਖਬਾਰਾਂ ਅਤੇ ਮੈਗਜ਼ੀਨਾਂ ਟੀ ਵੀ ਮੀਡੀਆ ਜਿਵੇਂ ਕਿ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਤਕਰੀਬਨ ਤਕਰੀਬਨ ਇਹ ਸਾਰੀਆਂ ਚੀਜ਼ਾਂ ਰਲਦੀਆਂ ਮਿਲਦੀਆਂ ਹੀ ਹਨ ਆਪਸ ਵਿੱਚ ਫਰਕ ਸਿਰਫ ਇੰਨਾ ਹੈ ਕਿ ਅਖਬਾਰਾਂ ਦੇ ਰਾਹੀਂ ਸਾਨੂੰ ਸਾਡੇ ਘਰ ਬੈਠਿਆਂ ਹੀ ਸਾਨੂੰ ਦੁਨੀਆ ਵਿੱਚ ਕੀ ਹੋ ਰਿਹਾ ਹੈ ਅਤੇ ਕੀ ਨਹੀਂ ਹੋ ਰਿਹਾ ਹੈ ਸਾਨੂੰ ਇਸ ਗੱਲ ਦੀ ਪਤਾ ਲੱਗ ਜਾਂਦਾ ਹੈ ਇਸ ਤੋਂ ਲੱਕੜ ਦੀ ਵੀ ਵੇਸਟੇਜ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੇਪਰ ਲੱਕੜ ਤੋਂ ਬਣਦਾ ਹੈ ਚਲੋ ਇਸਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਟੀ ਵੀ ਮੀਡੀਆ ਜਿਵੇਂ ਕਿ ਟੀ ਵੀ ਵਿੱਚ ਸਾਨੂੰ ਅੱਜ ਕੱਲ੍ਹ ਟੀ ਵੀ ਦਾ ਜ਼ਮਾਨਾ ਹੈ ਟੀ ਵੀ ਦਾ ਜ਼ਮਾਨਾ ਹੈ ਲੋਕ ਘਰ ਬੈਠਿਆਂ ਹੀ ਅਖਬਾਰਾਂ ਚੈਨਲ ਅਲੱਗ ਅਲੱਗ ਚੈਨਲ ਬਣਾਏ ਹੁੰਦੇ ਹਨ ਲੋਕਾਂ ਨੇ ਇਹਨਾਂ ਤੋਂ ਅਲੱਗ ਅਲੱਗ ਚੈਨਲਾਂ 'ਤੇ ਅਲੱਗ ਅਲੱਗ ਦੇਸ਼ਾਂ ਦੀਆਂ ਖਬਰਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਵਿੱਚ ਵੀ ਫਾਇਦੇ ਵੀ ਹਨ ਅਸਲ ਵਿੱਚ ਇਹ ਸਾਡੇ ਫਾਇਦੇ ਅਤੇ ਨੁਕਸਾਨ ਸਾਡੇ ਆਪਣੇ 'ਤੇ ਨਿਰਭਰ ਕਰਦੇ ਹੈ ਕਿ ਆਪਾਂ ਉਸ ਚੀਜ਼ ਨੂੰ ਕਿਵੇਂ ਯੂਜ ਕਰ ਰਹੇ ਹਾਂ ਆਪਾਂ ਉਸਨੂੰ ਗਲਤ ਕੰਮ ਲਈ ਵੀ ਯੂਜ ਕਰ ਸਕਦੇ ਹਾਂ ਅਤੇ ਚੰਗੇ ਕੰਮ ਲਈ ਵੀ ਯੂਜ ਕਰਦੇ ਹਾਂ ਜਿਵੇਂ ਕੁੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਵਿੱਚ ਉਹਨਾਂ ਨੂੰ ਆਜ਼ਾਦੀ ਮਿਲੀ ਹੈ ਤਾਂ ਉਹ ਪੂਰੀਆਂ ਹੀ ਆਜ਼ਾਦ ਹੋ ਗਈਆਂ ਹਨ ਆਪਣਾ ਸਾਰਾ ਟਾਈਮ ਸੋਸ਼ਲ ਮੀਡੀਆ 'ਤੇ ਕਈ ਬੱਚੇ ਯੂਜ ਕਰਦੇ ਹਨ ਕਈ ਗਲਤ ਚੀਜ਼ਾਂ ਵੇਖਦੇ ਹਨ ਸੋ ਇਸ ਚੀਜ਼ ਨੂੰ ਨਹੀਂ ਹੋਣਾ ਚਾਹੀਦਾ ਸਾਨੂੰ ਫੋਨ ਵਿੱਚੋਂ ਜਿੱਦਾਂ ਏ ਆਈ ਟੈਕਨੋਲਜੀ ਆ ਗਈ ਹੈ ਅੱਜ ਆਰਟੀਫਿਸ਼ਲ ਟੈਕਨੋਲਜੀ ਅੱਜ ਕੱਲ੍ਹ ਆਈ ਆਈ ਹੈ ਇਸ ਦੇ ਰਾਹੀਂ ਸਾਨੂੰ ਵਧੀਆ ਵਧੀਆ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਜਿਸ ਨਾਲ ਸਾਡਾ ਟਾਈਮ ਵੀ ਬਚਦਾ ਹੈ ਅਤੇ ਸਾਡਾ ਦਿਮਾਗ ਵੀ ਜ਼ਿਆਦਾ ਨਹੀਂ ਲੱਗਦਾ ਹੈ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਜੇਕਰ ਆਪਾਂ ਕਿਸੇ ਸਹੀ ਵਿਅਕਤੀ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਵਧੀਆ ਗੱਲ ਹੀ ਸਿੱਖਣ ਨੂੰ ਮਿਲਦੀ ਹੈ ਫਾਇਦੇ ਵੀ ਅਤੇ ਨੁਕਸਾਨ ਵੀ ਉਹ ਸਾਡੇ ਆਪਣੇ ਹੱਥ ਵਿੱਚ ਹੁੰਦੇ ਹਨ ਸੋ ਇਹਨਾਂ 'ਤੇ ਭਰੋਸਾ ਸਾਨੂੰ ਰੱਖਣਾ ਚਾਹੀਦਾ ਹੈ ਪਰ ਸਾਨੂੰ ਸਾਡੀ ਆਪਣੀ ਮੱਤ ਅਕਲ ਸਹੀ ਹੋਣੀ ਚਾਹੀਦੀ ਹੈ ਕਿ ਆਪਾਂ ਕਿਸ ਚੀਜ਼ 'ਤੇ ਭਰੋਸਾ ਕਰ ਰਹੇ ਹਾਂ ਅਤੇ ਕਿਸ 'ਤੇ ਨਹੀਂ ਕਰ ਰਹੇ ਹਾਂ